ਮੈਂ ਅਖਬਾਰ ਪੜ੍ਹਨਾ ਪਸੰਦ ਕਰਦੀ ਹਾਂ ਮੈਨੂੰ ਅਖਬਾਰ ਦੇ ਵਿੱਚ ਹੀ ਬਹੁਤ ਵਧੀਆ ਲੱਗਦਾ ਹੈ ਸਾਰੀਆਂ ਖਬਰਾਂ ਉਹਦੇ ਵਿੱਚ ਰੀਅਲ ਹੁੰਦੀਆਂ ਹਨ ਆਨਲਾਈਨ ਇੰਨੀਆਂ ਵਧੀਆ ਖਬਰਾਂ ਨਹੀਂ ਹੁੰਦੀਆਂ ਹੈਗੀਆਂ ਜਿੰਨੀਆਂ ਅਖਬਾਰ ਦੇ ਵਿੱਚ ਹੁੰਦੀਆਂ ਹਨ ਉਹਦੇ ਵਿੱਚ ਸਭ ਕੁਛ ਰੀਅਲ ਹੁੰਦਾ ਵਾ ਸਾਰੀਆਂ ਖਬਰਾਂ ਰੀਅਲ ਹੁੰਦੀਆਂ ਹਨ ਕੋਈ ਰਾਸ਼ੀਆਂ ਵਗੈਰਾ ਕੁਝ ਹੋਰ ਕਿੰਨਾ ਕੁਛ ਹੁੰਦਾ ਉਹਦੇ ਵਿੱਚ ਆਪਣੇ ਸਾਰੇ ਆਲੇ ਦੁਆਲੇ ਦੀਆਂ ਖਬਰਾਂ ਦੇਖ ਕੇ ਆਲੇ ਦੁਆਲੇ ਕੀ ਚੱਲ ਰਿਹਾ ਹੈ ਮੀਡੀਆ ਵਿੱਚ ਕੀ ਚੱਲ ਰਿਹਾ ਹੈ ਹਰ ਇੱਕ ਚੀਜ਼ ਬਾਰੇ ਨੌਲੇਜ ਮਿਲਦੀ ਹੈ ਚੁਟਕਲੇ ਆਉਂਦੇ ਹਨ ਹੋਰ ਮਤਲਬ ਜਿਵੇਂ ਕਿ ਕੋਈ ਕਿਚਨ ਦੀ ਰੈਸਪੀ ਵਗੈਰਾ ਉਹ ਵੀ ਆਉਂਦੀ ਆ ਔਰ ਉਹ ਮੈਨੂੰ ਉਹਦੇ ਉੱਤੇ ਬਹੁਤ ਭਰੋਸਾ ਹੈ ਅਸੀਂ ਅਜੀਤ ਅਖਬਾਰ ਹੀ ਪੜ੍ਹਦੇ ਹਾਂ ਜ਼ਿਆਦਾਤਰ ਔਰ ਟਾਈਮ ਪਾਸ ਲਈ ਵੀ ਬਹੁਤ ਵਧੀਆ ਹੈ ਹਰ ਇੱਕ ਚੀਜ਼ਾਂ ਜਦੋਂ ਆਪਣੇ ਕੋਲੇ ਜ਼ਿਆਦਾ ਆਨਲਾਈਨ ਚੀਜ਼ਾਂ ਲਈ ਸਾਰਾ ਕੁਝ ਦੇਖਣ ਨੂੰ ਮਨ ਭਰ ਜਾਂਦਾ ਹੈ ਤਾਂ ਆਪਾਂ ਨੂੰ ਕਿਤੇ ਵੀ ਜਾ ਕੇ ਅਖਬਾਰ ਪੜ੍ਹ ਸਕਦੇ ਹਾਂ ਅਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਇੱਦਾਂ ਦੀਆਂ ਚੀਜ਼ਾਂ ਦੇਖ ਕੇ